ਹੈਲੋ ਸਰ ਤੁਸੀਂ ਓਲਾ ਕੰਪਨੀ ਤੋਂ ਬੋਲਦੇ ਪਏ ਜੇ ਅਸੀਂ ਤੁਹਾਡੀ ਗੱਡੀ ਬੁੱਕ ਕਰਵਾਈ ਸੀ ਅਸੀਂ ਅਨੰਦਪੁਰ ਸਾਹਿਬ ਘੁੰਮਣ ਜਾਣਾ ਸੀਗਾ ਅਤੇ ਉੱਥੇ ਦਸ ਪੰਦਰਾ ਜਣੇ ਜੀਅ ਸਾਡੇ ਹੈਗੇ ਆ ਤਾਂ ਗੱਡੀ ਵਧੀਆ ਹੋਣੀ ਚਾਹੀਦੀ ਆ ਸੀਟਾਂ ਵੀ ਵਧੀਆ ਹੋਣ

ਅਸੀਂ ਜਲੰਧਰ ਰਹਿੰਦੇ ਸੀਗੇ ਹੁਣ ਅਸੀਂ ਇੱਥੇ ਖੰਡੂਰ ਸਾਹਿਬ ਆਏ ਹੋਏ ਹਾਂ ਅਤੇ ਤੁਹਾਨੂੰ ਜਲੰਧਰ ਦਾ ਅਡਰੈਸ ਦਿੱਤਾ ਸੀਗਾ ਅਤੇ ਖੰਡੂਰ ਸਾਹਿਬ ਆਉਣਾ ਉੱਥੇ ਆਣ ਕੇ ਸਾਨੂੰ ਲੈ ਜਾਓ ਅਸੀਂ ਪਹਿਲਾਂ ਜਿੱਥੇ ਰਹਿੰਦੇ ਸੀਗੇ ਉੱਥੇ ਹੁਣ ਨਹੀਂ ਹੈਗੇ ਤਾਂ ਸਾਨੂੰ ਆਣ ਕੇ ਇੱਥੋਂ ਲੈ ਜਾਓ ਦਸ ਪੰਦਰਾ ਜੀਅ ਅਤੇ ਗੱਡੀ ਵਧੀਆ ਹੋਣੀ ਚਾਹੀਦੀ ਆ ਇਸ ਤੋਂ ਔਰ ਸਾਨੂੰ ਕੁਛ ਨਹੀਂ ਚਾਹੀਦਾ ਵੀ ਕਿ ਅਸੀਂ ਹੋਰ ਵੀ ਕਿਤੇ ਜਾਣਾ ਵਾ ਚਾਰ ਵਜੇ ਦਾ ਸਾਡਾ ਟਾਈਮ ਆ ਅਤੇ ਚਾਰ ਵਜੇ ਤੋਂ ਪਹਿਲਾਂ ਗੱਡੀ ਭੇਜ ਦਿਓ ਕਿ ਜਿਹੜਾ ਅਸੀਂ ਆਪਣਾ ਟਾਈਮ ਸਿਰ 'ਤੇ ਜਾ ਚ ਚੱਲ ਜਾਈਏ ਇਹ ਨਾ ਹੁੰਦੀ ਹੋਵੇ ਕਿ ਅਸੀਂ ਤੁਹਾਨੂੰ ਉਡੀਕਦੇ ਰਹੀਏ ਅਤੇ ਤੁਸੀਂ ਲੇਟ ਹੋ ਜਾਓ